ਮੈਨੂੰ ਸ਼ੁਰੂ ਤੋਂ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੁੰਦਾ ਸੀ ਫਿਲਮਾਂ ਦੇਖਣ ਦਾ ਟੀ ਵੀ ਸ਼ੋਅਜ਼ ਦੇਖਣ ਦਾ ਵੀ ਬਹੁਤ ਸ਼ੌਂਕ ਹੁੰਦਾ ਸੀ ਜ਼ਿਆਦਾਤਰ ਮੈਂ ਫਰੀ ਟਾਈਮ ਕਦੇ ਕਦੇ ਕ ਕਿਤਾਬਾਂ ਪੜ੍ਹਦੀ ਹੁੰਦੀ ਸੀ ਕਦੇ ਅਤੇ ਕਦੇ ਕਦੇ ਟੀ ਵੀ ਵੀ ਦੇਖ ਲੈਂਦੀ ਹੁੰਦੀ ਸੀ ਜਿਹਦੇ ਵਿੱਚ ਫਿਲਮਾਂ ਵੀ ਹੁੰਦੀਆਂ ਸੀ ਅਤੇ ਸ਼ੋਅ ਵੀ ਦੇਖੀਦੇ ਹੁੰਦੇ ਸੀ ਅਤੇ ਅਸੀਂ ਸਾਰੀ ਫੈਮਿਲੀ ਇਕੱਠੀ ਹੋ ਕੇ ਦੇਖ ਲੈਂਦੀ ਹੁੰਦੀ ਸੀ ਅਤੇ ਜੇ ਕ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਸੀ ਜ਼ਿਆਦਾਤਰ ਮੇਰੇ ਘਰ 'ਚ ਮੈਂ ਹੀ ਪੜ੍ਹਦੀ ਹੁੰਦੀ ਸੀ ਅਤੇ ਮੈਨੂੰ ਸਭ ਤੋਂ ਵਧੀਆ ਮੇਰੀ ਫਿਲਮ ਉਹ ਲੱਗਦੀ ਹੁੰਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਤੇ ਉਹਦੇ ਵਿੱਚ ਜਿਵੇਂ ਕਿ ਸਾਨੂੰ ਪੁਰਾਣੇ ਸਮੇਂ ਵਿੱਚ ਕੀ ਕੀ ਹੋਇਆ ਸੀ ਕਿਵੇਂ ਲੜਾਈਆਂ ਹੋਈਆਂ ਸੀ ਉਹਦੇ ਬਾਰੇ ਪੂਰਾ ਵਰਣਨ ਦਿੱਤਾ ਗਿਆ ਆ ਕਿਵੇਂ ਵਿਰੋਧੀਆਂ ਵੱਲੋਂ ਜਿਹੜੇ ਮ ਮੁਗਲ ਹੈ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕੀਤਾ ਗਿਆ ਹੈ ਨਾ ਉਸ ਸਮੇਂ ਦੀਆਂ ਸਾਰੀਆਂ ਘਟਨਾਵਾਂ ਬਾਰੇ ਦੱਸਿਆ ਜਾਂਦਾ ਏ ਅਤੇ ਕਿਵੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਕੀ ਹੋਣਾ ਕੀ ਘਟਨਾ ਹੈ ਨਾ ਅੱਗੇ ਅਤੇ ਕਿਵੇਂ ਯੁੱਧ ਯ ਹੋਏ ਸੀ ਸਾਰੀ ਡਿਟੇਲ ਦ ਦੱਸੀ ਗਈ ਸੀ ਅਤੇ ਗੁਰੂ ਸਾਹਿਬਾਂ ਦੇ ਸਾਰੀਆਂ ਘਟਨਾਵਾਂ ਬਾਰੇ ਵੀ ਦੱਸਿਆ ਜਾਂਦਾ ਸੀ ਅਤੇ ਮੈਨੂੰ ਬਹੁਤ ਹੀ ਵਧੀਆ ਫਿਲਮ ਲੱਗਦੀ ਹੁੰਦੀ ਸੀ ਬਹੁਤ ਭਾਵੁਕ ਕਰਨ ਵਾਲੀ ਫਿਲਮ ਹੁੰਦੀ ਸੀ ਉਹ ਅਤੇ ਮੇਰੀ ਮਨਪਸੰਦ ਫਿਲਮ ਉਹੀ ਹੁੰਦੀ ਸੀ ਅਤੇ ਹੋਰ ਵੀ ਆਪਾਂ ਕਿਤਾਬਾਂ ਵੀ ਨਾਲ ਪੜ੍ਹਦੇ ਹੁੰਦੇ ਸੀ ਕਿਤਾਬਾਂ 'ਚ ਵੀ ਬਹੁਤ ਵਧੀਆ ਕਿਤਾਬਾਂ ਵਦੀਆਂ ਹੁੰਦੀਆਂ ਸੀ ਅਤੇ ਟੀ ਵੀ ਸ਼ੋਅਜ਼ ਵੀ ਵਧੀਆ ਲੱਗਦੇ ਸੀ ਪਰ ਜ਼ਿਆਦਾਤਰ ਮੈਨੂੰ ਸਭ ਤੋਂ ਵਧੀਆ ਉਹੀ ਫਿਲਮ ਲੱਗਦੀ ਹੁੰਦੀ ਸੀ ਉਹ ਭਾਵੇਂ ਜਿੰਨੀ ਵਾਰੀ ਮਰਜ਼ੀ ਟੀ ਵੀ 'ਤੇ ਆਏ ਅਤੇ ਮੈਂ ਦੇਖਦੀ ਹੁੰਦੀ ਸੀ ਕਿਉਂਕਿ ਉਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੁੰਦੀ ਸੀ